ਅਸੀਂ ਬਠਿੰਡੇ ਤੋਂ ਹਿਮਾਚਲ ਦਾ ਟੂਰ ਗਏ ਬਠਿੰਡਾ ਅਸੀਂ ਸੁਬਹਾ ਸੁਬਹਾ ਇੱਥੋਂ ਪੰਜ ਵਜੇ ਚੱਲੇ ਪਹਿਲਾਂ ਅਸੀਂ ਚੰਡੀਗੜ੍ਹ ਗਏ ਚੰਡੀਗੜ੍ਹ ਸਾਰਾ ਤੋਂ ਸਵੇਰ ਅਤੇ ਫਿਰ ਅਸੀਂ ਸ਼ਿਮਲੇ ਪਹੁੰਚੇ ਸ਼ਿਮਲੇ ਬਹੁਤ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਜਿਸ ਵਿੱਚ ਜਿਸ ਵਿੱਚ ਬਹੁਤ ਵੱਡੇ ਪਹਾੜ ਅਤੇ ਠੰਡੀਆਂ ਛਾਵਾਂ ਬਹੁਤ ਬਾਰਿਸ਼ ਵਾਲਾ ਮੌਸਮ ਸੀ ਬਹੁਤ ਆਨੰਦ ਆਉਂਦਾ ਸੀ ਜਿਸ ਨਾਲ ਜਿਸ ਵਿੱਚ ਅਸੀਂ ਬਹੁਤ ਤਰ੍ਹਾਂ ਦੇ ਪਹਾੜ ਵੀ ਹੁੰਦੇ ਸਨ ਅਤੇ ਠੰਡ ਜ਼ਿਆਦਾ ਪੈਣ ਕਾਰਨ ਅਸੀਂ ਹੌਲੀ ਹੌਲੀ ਅੱਗੇ ਵਧੇ ਅਤੇ ਬਾਰਿਸ਼ ਵੀ ਤੇਜ਼ ਸੀ ਫਿਰ ਅਸੀਂ ਇਸ ਹੋਟਲ 'ਤੇ ਰੁਕੇ ਉੱਥੇ ਅਸੀਂ ਖਾਣਾ ਸ਼ਾਮ ਦਾ ਖਾਣਾ ਖਾਧਾ ਅਤੇ ਸੌ ਗਏ ਸੁਬਹਾ ਉੱਠੇ ਫੇਰ ਅਸੀਂ ਉੱਥੋਂ ਹੁੰਦੇ ਹੋਏ ਸਿਮਲੇ ਤੋਂ ਅਸੀਂ ਨੈਣਾਂ ਦੇਵੀ ਸ ਨੈਣਾਂ ਦੇਵੀ ਚਲੇ ਗਏ ਨੈਣਾਂ ਦੇਵੀ ਮਾਤਾ ਦੇ ਮੰਦਰ 'ਚ ਗਏ ਉੱਥੇ ਵੀ ਬਹੁਤ ਵ ਵਧੀਆ ਚੀਜ਼ਾਂ ਅ ਵੇਖੀਆਂ ਅਸੀਂ ਮੋ ਬਹੁਤ ਉੱਚੇ ਉੱਚੇ ਪਹਾੜ ਸੀ ਮਾਤਾ ਦਾ ਮੰਦਰ ਸੀ ਬਹੁਤ ਵੱਡਾ ਉੱਥੇ ਅਸੀਂ ਪਹੁੰਚੇ ਅਤੇ ਫਿਰ ਅਸੀਂ ਵਾਪਸ ਪਠਾਨਕੋਟ ਹੁੰਦਿਆਂ ਹੋਇਆਂ ਅੰਮ੍ਰਿਤਸਰ ਅੰਮ੍ਰਿਤਸਰ ਮੱਥਾ ਟੇਕਿਆ ਫਿਰ ਅਸੀਂ ਅੰਬਰਸਰ ਤੋਂ ਅਸੀਂ ਲੁਧਿਆਣੇ ਲੁਧਿਆਣੇ ਤੋਂ ਫਿਰ ਅਸੀਂ ਬਠਿੰਡਾ ਪਹੁੰਚੇ ਬਹੁਤ ਵਧੀਆ ਚੀਜ਼ਾਂ ਮਿਲੀਆਂ ਧੰਨਵਾਦ ਜੀ